ਹਾਂਜੀ ਅਸੀਂ ਆਪਣੀ ਸੰਧਾਈ ਹਫ਼ਤਾਵਾਰੀ ਵੱਖ ਵੱਖ ਤਰੀਕਿਆਂ ਨਾਲ ਆਯੋਜਿਤ ਕਰ ਸਕਦੇ ਹਾਂ ਜਿਸ ਦੇ ਨਾਲ ਸਾਨੂੰ ਆਪਣੇ ਹਰ ਇੱਕ ਸ਼ਾਮ ਅਲੱਗ ਅਲੱਗ ਤਰੀਕੇ ਨਾਲ ਅਤੇ ਵੱਖਰੇ ਵੱਖਰੇ ਗਤੀਵਿਧੀਆਂ ਨਾਲ ਕਰ ਸਕਦੇ ਹਾਂ ਆਪਣੇ ਪਰਿਵਾਰ ਨੂੰ ਇਸ ਦਾ ਹਿੱਸਾ ਬਣਾ ਸਕਦੇ ਹਾਂ ਅਤੇ ਆਪਣੇ ਬੱਚਿਆਂ ਲਈ ਖੇਡਾਂ ਰੱਖ ਸਕਦੇ ਹਾਂ ਸ਼ਾਮ ਦਾ ਸਾਰਾ ਖਾਣਾ ਵੀ ਇਕੱਠੇ ਬੈਠ ਕੇ ਖਾ ਸਕਦੇ ਹਾਂ ਅਤੇ ਆਪਸ ਵਿੱਚ ਪਿਆਰ ਵਧਾ ਸਕਦੇ ਹਾਂ ਇਸ ਦੇ ਨਾਲ ਹੀ ਸੰਧਾਈ ਹਫ਼ਤਾਵਾਰੀ ਆਯੋਜਿਤ ਬਹੁਤ ਹੀ ਵਧੀਆ ਹੋ ਸਕਦੀ ਹੈ ਅਤੇ ਅਲੱਗ ਅਲੱਗ ਤਰੀਕਿਆਂ ਨਾਲ ਅਸੀਂ ਸਾਰੇ ਇਕੱਠੇ ਬੈਠ ਕੇ ਹਫ਼ਤਾਵਾਰੀ ਆਯੋਜਿਤ ਨਾਲ ਹੀ ਸੰਧਾਈ ਆਪਣਾ